ਭੰਗੜਾ ਸਾਡੇ ਪੰਜਾਬ ਦਾ ਬਹੁਤ ਹੀ ਪ੍ਰਸਿੱਧ ਨਾਚ ਹੈ ਭੰਗੜਾ ਪੰਜਾਬ ਵਿੱਚ ਬਹੁਤ ਹੀ ਲੋਕ ਚੰਗੀ ਤਰ੍ਹਾਂ ਇਸ ਨੂੰ ਇੰਜੋਏ ਕਰਦੇ ਹਨ ਭੰਗੜੇ ਵਿੱਚ ਔਰਓਬਿਕਸ ਨੂੰ ਮਜ਼ੇਦਾਰ ਬਣਾਉਣ ਲਈ ਕੀ ਭੂਮਿਕਾ ਨਿਭਾਉਂਦਾ ਹੈ ਇਹ ਭੰਗੜਾ ਐਰੋਬਿਕਸ ਤੋਂ ਬਿਨਾਂ ਨਹੀਂ ਪਾਇਆ ਜਾ ਸਕਦਾ ਨਹੀਂ ਜੱਚਦਾ ਇਸ ਤੋਂ ਬਿਨਾਂ ਭੰਗੜਾ ਭੰਗੜਾ ਇੱਕ ਤਾਂ ਢੋਲਕ ਨਾਲ ਹੋਣਾ ਚਾਹੀਦਾ ਅਤੇ ਨਾਲ ਪੰਜਾਬੀ ਬੋਲੀਆਂ ਪਾਉਣ ਵਾਲਾ ਇੱਕ ਨਾਲ ਸਹਿ ਕਲਾਕਾਰ ਹੋਣਾ ਚਾਹੀਦਾ ਹੈ ਫਿਰ ਹੀ ਆਪਣਾ ਭੰਗੜਾ ਵਧੀਆ ਜੱਚਦਾ ਹੈ ਕਿਉਂਕਿ ਕੋਈ ਵੀ ਚੀਜ਼ ਹੈ ਜੋ ਸੰਗੀਤ ਨੇ ਨਾਲ ਬਣੀ ਹੈ ਤਾਂ ਉਹ ਸੰਗੀਤ ਨਾਲ ਹੀ ਸੋਹਣੀ ਲੱਗਦੀ ਹੈ ਬਿਨਾਂ ਢੋਲੀ ਤੋਂ ਬਿਨਾਂ ਸੰਗੀਤ ਤੋਂ ਭੰਗੜਾ ਨਹੀਂ ਜਚਦਾ ਭੰਗੜਾ ਪਾਉਣ ਲਈ ਇੱਕ ਟੀਮ ਵਰਕ ਕਰਨਾ ਪੈਂਦਾ ਹੈ ਭੰਗੜਾ ਪਾਉਣ ਲਈ ਇੱਕ ਟੀਮ ਵਰਕ ਦੇ ਨਾਲ ਨਾਲ ਅੱਠ ਬੰਦਿਆਂ ਦੀ ਟੀਮ ਹੁੰਦੀ ਹੈ ਜੋ ਕਿ ਤਾਲ ਨਾਲ ਤਾਲ ਲਾ ਕੇ ਸਟੈਪ ਨਾਲ ਸਟੈਪ ਮਿਲਾ ਕੇ ਵਧੀਆ ਭੰਗੜਾ ਪੋ ਬਣਦਾ ਹੈ ਭੰਗੜਾ ਸਾਡੇ ਜਿਵੇਂ ਕਾਲਜਾਂ ਸਕੂਲਾਂ ਪੰਜਾਬੀ ਯੂਨੀਵਰਸਿਟੀਆਂ 'ਚ ਇੱਕ ਨੰਬਰ 'ਤੇ ਨਾਚ ਆਉਂਦਾ ਹੈ ਲੋਕ ਇਹਨੂੰ ਬਹੁਤ ਇੰਜੋਏ ਕਰਦੇ ਹਨ ਭੰਗੜਾ ਪਾਉਣ ਲਈ ਇੱਕ ਟੀਮ ਵਰਕ ਦਾ ਕੰਮ ਕਰਨਾ ਪੈਂਦਾ ਹੈ ਜੋ ਕਿ ਸਟੈਪ ਨਾਲ ਸਟੈਪ ਮਿਲਾ ਕੇ ਇੱਕ ਦੂਜੇ ਦੀ ਸਟੈਪ ਨਾਲ ਸਟੈਪ ਮਿਲਾਉਣਾ ਪੈਂਦਾ ਹੈ ਭੰਗੜਾ ਸਾਡੇ ਸ਼ੁਰੂ ਤੋਂ ਹੀ ਬਹੁਤ ਪ੍ਰਸਿੱਧ ਹੈ ਤੁਹਾਡੇ ਪੰਜਾਬ ਪਾਕਿਸਤਾਨ ਸਭ ਮੁਲਕਾਂ ਵਿੱਚ ਭੰਗੜੇ ਨੂੰ ਬਹੁਤ ਮਹੱਤਤਾ ਦਿੱਤੀ ਜਾਂਦੀ ਹੈ ਭੰਗੜੇ ਨਾਲ ਲੋਕਾਂ ਵਿੱਚ ਦੇਖ ਕੇ ਖੁਸ਼ੀ ਦਾ ਮਾਹੌਲ ਬਣਦਾ ਹੈ ਲੋਕ ਤਾੜੀਆਂ ਵਜਾਉਂਦੇ ਹਨ ਨਾਚ ਲੋਕ ਨਾਲ ਵੀ ਆਪਣਾ ਸਟੇਜਾਂ ਤੋਂ ਥੱਲੇ ਲੋਕ ਭੰਗੜਾ ਪਾਉਣ ਲੱਗ ਜਾਂਦੇ ਹਨ ਭੰਗੜਾ ਇੱਕ ਇਹੋ ਜਿਹੀ ਚੀਜ਼ ਹੈ ਜੋ ਐਨਰਜੀ ਦਿੰਦਾ ਹੈ ਬੰਦੇ ਨੂੰ ਜੋ ਵੀ ਬੰਦਾ ਬੈਠ ਕੇ ਦੇਖਦਾ ਉਸਨੂੰ ਐਨਰਜੀ ਆਉਣ ਲੱਗ ਜਾਂਦੀ ਹੈ ਭੰਗੜਾ ਪੰਜਾਬ ਦਾ ਇੱਕ ਪ੍ਰਸਿੱਧ ਨਾ ਉਹ ਹੈ ਨਾਚ ਹੈ ਜੋ ਕਿ ਬਹੁਤ ਹੀ ਉਹ ਭੰਗੜੇ ਨੂੰ ਲੋਕ ਉਤਸ਼ਾਹ ਨਾਲ ਦੇਖਦੇ ਹਨ ਧੰਨਵਾਦ